ਮੈਂ ਕਈ ਵਾਰ ਡਿਜੀਟਲ ਡਰਾਇੰਗ ਟੂਲਸ ਦੀ ਵਰਤੋਂ ਕੀਤੀ ਹੈ ਅਤੇ ਮੈਨੂੰ ਇਹ ਬਹੁਤ ਦਿਲਚਸਪ ਲੱਗਿਆ ਡਿਜੀਟਲ ਡਰਾਇੰਗ ਟੂਲਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਹੁਤ ਹੀ ਲਚਕਦਾਰ ਹੁੰਦੇ ਹਨ ਤੁਸੀਂ ਆਪਣੀ ਇੱਛਾ ਅਨੁਸਾਰ ਕਿਸੇ ਵੀ ਰੰਗ ਬਰੱਸ਼ ਜਾਂ ਟੂਲ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹੋ ਤੁਸੀਂ ਆਪਣੀ ਡਰੋਇੰਗ ਨੂੰ ਕਈ ਲੇਅਰਾਂ ਵਿੱਚ ਬਣਾ ਸਕਦੇ ਹੋ ਜੋ ਕਿ ਬਹੁਤ ਹੀ ਫਾਇਦੇਮੰਦ ਹੈ ਰਵਾਇਤੀ ਤਰੀਕਿਆਂ ਵਿੱਚ ਤੁਸੀਂ ਜਿਵੇਂ ਤੁਸੀਂ ਪੈਂਸਿਲ ਜਾਂ ਰੰਗਾਂ ਨਾਲ ਡਰੋਇੰਗ ਕਰਨਾ ਤੁਹਾਨੂੰ ਸੀਮਤ ਰੰਗਾਂ ਅਤੇ ਟੂਲਸ ਦੀ ਵਰਤੋਂ ਕਰਨੀ ਪੈਂਦੀ ਹੈ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਇਸ ਨੂੰ ਠੀਕ ਕਰਨਾ ਮੁਸ਼ਕਿਲ ਹੋ ਸਕਦਾ ਹੈ ਰਿਵਾਇਤੀ ਤਰੀਕਿਆਂ ਨਾਲ ਡਰਾਇੰਗ ਕਰਨ ਵਿੱਚ ਸਮਾਂ ਵੀ ਜ਼ਿਆਦਾ ਲੱਗਦਾ ਹੈ ਪਰ ਡਿਜੀਟਲ ਡਰਾਇੰਗ ਟੂਲਸ ਦਾ ਇੱਕ ਮਤਲਬ ਇਹ ਨਹੀਂ ਹੈ ਕਿ ਰਿਵਾਇਤੀ ਤਰੀਕੇ ਬੇਕਾਰ ਹਨ ਰਿਵਾਇਤੀ ਤਰੀਕੇ ਨਾਲ ਡਰਾਇੰਗ ਕਰਨ ਦਾ ਆਪਣਾ ਹੀ ਇੱਕ ਅਨੁਭਵ ਹੁੰਦਾ ਹੈ ਇਹ ਤੁਹਾਨੂੰ ਕਾਗਜ਼ ਅਤੇ ਰੰਗਾਂ ਦਾ ਅਸਲ ਭਾਵਨਾ ਦਿੰਦੇ ਹਨ ਜੋ ਕਿ ਡਿਜੀਟਲ ਡਰਾਇੰਗ ਵਿੱਚ ਨਹੀਂ ਮਿਲਦੀ ਮੈਨੂੰ ਲੱਗਦਾ ਹੈ ਕਿ ਦੋਵੇਂ ਤਰੀਕਿਆਂ ਦਾ ਆਪਣਾ ਇੱਕ ਮਹੱਤਵ ਹੈ ਡਿਜੀਟਲ ਡਰਾਇੰਗ ਟੂਲਸ ਤੁਹਾਨੂੰ ਤੇਜ਼ੀ ਨਾਲ ਅਤੇ ਆਸਾਨੀ ਨਾਲ ਡਰਾਇੰਗ ਕਰਨ ਵਿੱਚ ਮਦਦ ਕਰਦੇ ਹਨ ਜਦੋਂ ਕਿ ਰਿਵਾਇਤੀ ਤਰੀਕੇ ਤੁਹਾਨੂੰ ਕਲਾ ਦੀ ਅਸਲ ਭਾਵਨਾ ਦਿੰਦੇ ਹਨ ਇਸ ਲਈ ਮੈਂ ਕਹਿੰਦੀ ਹਾਂ ਕਿ ਕਲਾਕਾਰਾਂ ਨੂੰ ਦੋਵੇਂ ਤਰੀਕਿਆਂ ਦੀ ਵਰਤੋਂ ਕਰਨੀ ਆਉਣੀ ਚਾਹੀਦੀ ਹੈ ਡਿਜੀਟਲ ਡਰਾਇੰਗ ਟੂਲਸ ਤੁਹਾਨੂੰ ਆਪਣੀ ਕਲਾ ਨੂੰ ਹੋਰ ਬਿਹਤਰ ਕਰਨਾ ਕਰਨ ਵਿੱਚ ਮਦਦ ਕਰਦੇ ਹਨ ਜਦੋਂ ਕਿ ਰਿਵਾਇਤੀ ਤਰੀਕੇ ਤੁਹਾਨੂੰ ਆਪਣੀ ਕਲਾ ਨੂੰ ਅਸਲ ਭਾਵਨਾ ਦੇ ਦੇ ਸਕਦੇ ਹਨ